ਭੰਗੜਾ ਸਾਡੇ ਪੰਜਾਬੀਆਂ ਦਾ ਮਹੱਤਵਪੂਰਨ ਭੰਗੜਾ ਹੈ ਭੰਗੜਾ ਸਾਡੇ ਮੁੱਢ ਤੋਂ ਚੱਲਦਾ ਆਇਆ ਹੈ ਕੋਈ ਵੀ ਤਿਉਹਾਰ ਪ੍ਰੋਗਰਾਮ ਹੋਵੇ ਤਾਂ ਭੰਗੜਾ ਪਾਇਆ ਜਾਂਦਾ ਹੈ ਸਾਨੂੰ ਭੰਗੜਾ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਭੰਗੜਾ ਕਰਨ ਨਾਲ ਸਾਹਮਣੇ ਵਾਲੇ ਦਾ ਮਨੋਰੰਜਨ ਹੁੰਦਾ ਹੈ ਭੰਗੜਾ ਮੁੰਡਿਆਂ ਦੀ ਪੁਰਾਣੀ ਖੇਡ ਹੈ ਭੰਗੜਾ ਹਰੇਕ ਪ੍ਰੋਗਰਾਮ ਅਤੇ ਹੋਰ ਤਿਉਹਾਰਾਂ 'ਤੇ ਪਾਇਆ ਜਾਂਦਾ ਹੈ ਭੰਗੜੇ ਕੁੜੀਆਂ ਅਤੇ ਮੁੰਡੇ ਵੀ ਪਾਉਂਦੇ ਹਨ ਲੋਕ ਭੰਗੜਾ ਦੇਖ ਕੇ ਬਹੁਤ ਖੁਸ਼ ਰਹਿੰਦੇ ਹਨ ਭੰਗੜਾ ਮੁੰਡੇ ਬਹੁਤ ਸ਼ੌਂਕ ਨਾਲ ਪਾਉਂਦੇ ਹਨ ਭੰਗੜਾ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਮੰਨਿਆ ਗਿਆ ਹੈ ਇਹ ਪੰਜਾਬੀ ਲੋਕ ਬਹੁਤ ਪ੍ਰਸ ਪਸੰਦ ਕਰਦੇ ਹਨ